ਸਾਡੇ ਨਿੱਜੀ ਖੇਤਰ ਵਿੱਚ ਬਹੁਤ ਸਾਰੀਆਂ ਲਾਈਬ੍ਰੇਰੀਆਂ ਹਨ ਜਿਨਾਂ ਨੂੰ ਮੈਂ ਦੇਖਿਆ ਹੋਇਆ ਹੈ ਇਸ ਤੋਂ ਇਲਾਵਾ ਮੈਂ ਜਿੱਥੇ ਸਫਰ ਕਰਦਾ ਹਾਂ ਸੈਕਟਰ ਸਤਾਰ੍ਹਾਂ ਉੱਥੇ ਵੀ ਬਹੁਤ ਹੀ ਵੱਡੀ ਲਾਇਬ੍ਰੇਰੀ ਹੈ ਮੇਰੇ ਘਰ ਵਿੱਚ ਕੋਈ ਨਿੱਜੀ ਲਾਈਬ੍ਰੇਰੀ ਤਾਂ ਨਹੀਂ ਹੈ ਪਰ ਮੈਂ ਬਹੁਤ ਸਾਰੀਆਂ ਕਿਤਾਬਾਂ ਰੱਖੀਆਂ ਹੋਈਆਂ ਨੇ ਜਿਨਾਂ ਵਿੱਚ ਕੌਮਿਕਸ ਗਿਆਨ ਦੀ ਕਿਤਾਬਾਂ ਪੜ੍ਹਨ ਦੀ ਕਿਤਾਬਾਂ ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਨੋਵਲ ਹਨ ਮੈਂ ਆਪਣੇ ਸੁਪਨੇ ਦੀ ਲਾਈਬ੍ਰੇਰੀ ਬਾਰੇ ਬਹੁਤ ਸੋਚਿਆ ਹੋਇਆ ਹੈ ਕਿ ਜਦੋਂ ਮੈਂ ਆਪਣਾ ਘਰ ਬਣਾਉਂਗਾ ਤਾਂ ਉਸ ਵਿੱਚ ਇੱਕ ਖੇਤਰ ਅਲੱਗ ਐਹ ਜਿਹਾ ਹੋਵੇਗਾ ਜਿਸ ਵਿੱਚ ਹਰ ਤਰ੍ਹਾਂ ਦੀਆਂ ਕਿਤਾਬਾਂ ਹੋਣਗੀਆਂ ਤਾਂ ਜੋ ਕੌਮਿਕਸ ਪੜ੍ਹਨ ਵਾਲਾ ਬੰਦਾ ਕੌਮਿਕਸ ਪੜ੍ਹ ਸਕੇ ਅਤੇ ਜਿਸ ਨੂੰ ਨੋਵਲ ਪੜ੍ਹਨੇ ਹੋਣ ਉਹ ਆਪਣੇ ਨੋਵਲ ਪੜ੍ਹ ਸਕੇ ਅਤੇ ਜਿਨਾਂ ਨੂੰ ਕੋਈ ਸਿੱਖਿਆ ਬੰਦ ਕਿਤਾਬ ਚਾਹੀਦੀ ਹੋਊਂਗੀ ਉਸਨੂੰ ਉਹ ਕਿਤਾਬ ਉੱਥੇ ਮਿਲੂਂਗੀ ਇਸ ਤੋਂ ਇਲਾਵਾ ਉਹ ਸਥਾਨ ਇਕਾਂਤ ਹੋਵੇਗਾ ਜਿੱਥੇ ਕਿਸੀ ਨੂੰ ਕੋਈ ਡਿਸਟਰਬੈਂਸ ਨਾ ਹੋਵੇ ਮੇਰੇ ਘਰ ਦੇ ਨੇੜੇ ਹੀ ਇੱਕ ਲਾਈਬ੍ਰੇਰੀ ਹੈ ਮੈਂ ਉੱਤੇ ਜਾਂਦਾ ਵੀ ਹਾਂ ਅਤੇ ਆਪਣੀ ਸਹੂਲਤ ਅਨੁਸਾਰ ਆਪਣੀ ਇੱਛਾ ਅਨੁਸਾਰ ਕੌਮਿਕਸ ਪੜ੍ਹਦਾ ਹਾਂ ਗਿਆਨਵਰਤ ਕਿਤਾਬਾਂ ਪੜ੍ਹਦਾ ਹਾਂ ਇਸ ਤੋਂ ਇਲਾਵਾ ਮੈਨੂੰ ਜਿੱਥੇ ਵੀ ਕਿਤੇ ਬੁੱਕ ਮੇਲਾ ਹੁੰਦਾ ਹੈ ਮੈਂ ਉੱਥੇ ਜਾ ਕੇ ਆਪਣੀ ਪਸੰਦੀਦਾ ਬੁੱਕਾਂ ਖਰੀਦਦਾ ਹਾਂ ਤਾਂ ਜੋ ਕਿਸੇ ਨੂੰ ਵੀ ਜੇ ਲੋੜ ਹੋਵੇ ਤਾਂ ਮੈਂ ਉਹ ਕਿਤਾਬਾਂ ਪੜ੍ਹ ਕੇ ਦੇ ਸਕਾਂ ਤਾਂ ਕਿਉਂਕਿ ਕਿਤਾਬਾਂ ਹੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਬੰਦਿਆਂ ਦੇ ਵਿਚਾਰਾਂ ਨੂੰ ਸਿੱਧਾ ਕਰਦੀਆਂ ਹਨ ਅਤੇ ਉਹਨਾਂ ਤੋਂ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਕਿਤਾਬਾਂ ਹੀ ਬੰਦੇ ਦੇ ਮਾਨਸਿਕ ਸਥਿਤੀ ਨੂੰ ਬਹੁਤ ਜ਼ਿਆਦਾ ਅੱਛਾ ਕਰ ਸਕਦੀਆਂ ਹਨ ਕਿਤਾਬਾਂ ਨਾਲ ਹੀ ਬੰਦੇ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਜੋ ਸ਼ਾਂਤੀ ਸਾਨੂੰ ਕਿਥੇ ਨਹੀਂ ਮਿਲਦੀ ਉਹ ਸਾਨੂੰ ਕਿਤਾਬਾਂ ਵਿੱਚ ਮਿਲਦੀ ਹੈ ਕਿਤਾਬਾਂ ਵਿੱਚ ਇੰਨੀ ਸਿੱਖਿਆਵਾਂ ਮਿਲਦੀਆਂ ਹਨ ਕਿ ਤਾਂ ਜੋ ਮਨੁੱਖ ਆਪਣੀ ਜ਼ਿੰਦਗੀ ਵਿੱਚ ਬਹੁਤ ਅੱਛੀਆਂ ਅੱਛੀਆਂ ਚੀਜ਼ਾਂ ਕਰ ਸਕਦਾ ਹੈ ਕਿਤਾਬਾਂ ਇੱਕ ਆਸ ਹਨ ਜਿਸਨੇ ਪੜ੍ਹਾਈ ਕਰਨੀ ਹੈ ਉਸ ਦੀ ਪਿਆਸ ਹਨ ਲਾਈਬ੍ਰੇਰੀ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਅਸੀਂ ਜਾ ਕੇ ਸਭ ਕੁਝ ਕਰ ਸਕਦੇ ਹਾਂ ਸੋਚ ਸਕਦੇ ਹਾਂ ਮਨ ਨੂੰ ਆਜ਼ਾਦ ਰੱਖ ਕੇ ਸੋਚ ਸਕਦੇ ਹਾਂ ਇਕਾਂਤ ਵਿੱਚ ਪੜ੍ਹ ਕੇ ਆਪਣੇ ਗਿਆਨ ਨੂੰ ਵਧਾ ਸਕਦੇ ਹਾਂ ਕਿਤਾਬਾਂ ਇਹੋ ਜਿਹੇ ਗਿਆਨ ਦਾ ਭੰਡਾਰ ਹਨ ਜਿੰਨਾ ਤੁਸੀਂ ਡੁੱਬੋਗੇ ਉਨਾ ਤੁਹਾਨੂੰ ਸਿਖਾਉਂਗੀ